ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਦਰਅਸਲ ਮੈਂ ਨਾ ਉਹ ਬੱਚੇ ਪ੍ਰੀਤ ਨੂੰ ਛੁੱਟੀ ਕਰਵਾਉਣ ਆਈ ਹਾਂ ਪ੍ਰੀਤ ਦੀ ਮੰਮਾ ਬੋਲਦੀ ਹਾਂ ਛੁੱਟੀ ਕਰਨੀ ਹੈ ਉਹਨੂੰ ਲੈਣੀ ਹੈ ਸਾਡੇ ਨਾ ਫੈਮਿਲੀ ਮੈਂਬਰ ਵਿਆਹ ਆ ਅਤੇ ਫੰਕਸ਼ਨ ਹੈ ਜ਼ਰੂਰੀ ਹੈ ਅਤੇ ਸਾਨੂੰ ਤੁਸੀਂ ਛੁੱਟੀ ਦੇ ਦਿਉ ਹੁਣ ਬੱਚੇ ਨੂੰ ਅੱਛਾ ਜੀ ਉਹ ਫੰਕਸ਼ਨ ਸੀ ਸੀ ਨਾ ਆਪਣੀ ਫੈਮਲੀ ਫੰਕਸ਼ਨ ਹੀ ਇਹਦੇ ਇਸ ਕਰਕੇ ਮੈਂ ਕਿਹਾ ਚਲੋ ਅੱਛਾ ਜੀ ਨਹੀਂ ਠੀਕ ਹੈ ਜੀ ਚਲੋ ਕੋਈ ਨਹੀਂ ਦੇ ਦਿਉ ਫਿਰ ਹੁਣ ਚਲੋ ਬੱਚੇ ਵੇਖਦੇ ਹੈ ਜਾਂਦੇ ਆਉਂਦੇ ਹੈ ਵਿਆਹ ਇਸ ਤਰ੍ਹਾਂ ਵੇਖਣਾ ਉਹਨੇ ਫੰਕਸ਼ਨ ਦੇ ਦਿਉ ਤੁਸੀਂ ਛੁੱਟੀ ਹੁਣ ਅੱਗੋਂ ਤੋਂ ਨਹੀਂ ਨਹੀਂ ਕਰਵਾਉਂਦੇ ਠੀਕ ਹੈ ਹਾਂਜੀ ਓਕੇ ਬਾਏ